ਮੈਂ ਕਿਸੇ ਵੀ ਕਿਤਾਬ ਨੂੰ ਪੜ੍ਹਨ ਵਾਸਤੇ ਇੱਦਾਂ ਕੋਈ ਵਿਸ਼ੇਸ਼ ਟਾਰਗਟ ਸੈੱਟ ਨਹੀਂ ਕੀਤਾ ਹੁੰਦਾ ਕਿ ਮੈਂ ਇੰਨੇ ਸਮੇਂ 'ਚ ਪੜ੍ਹ ਦੇਣੀ ਹੈ ਕਿਉਂਕਿ ਕਿਤਾਬ ਪੜ੍ਹਨ ਲਈ ਉਹਦੇ ਵਿਸ਼ੇ ਦੇ ਵਿੱਚ ਇੰਟਰਸਟ ਹੋਣਾ ਇਹ ਸਭ ਤੋਂ ਵੱਡਾ ਪਹਿਲੂ ਹੁੰਦਾ ਹੈ ਹਾਲਾਂਕਿ ਮੇਰਾ ਇੱਕ ਮਾਨਸਿਕ ਵਿਚਾਰ ਹੁੰਦਾ ਹੈ ਕਿ ਹਫਤੇ ਤੋਂ ਲੈ ਕੇ ਦਸ ਦਿਨ ਦੇ ਵਿੱਚ ਵਿੱਚ ਅਗਰ ਕਿਤਾਬ ਮੈਂ ਪੂਰੀ ਪੜ੍ਹ ਦੇਵਾਂ ਤਾਂ ਚੰਗਾ ਹੈ ਨਹੀਂ ਤਾਂ ਜਦੋਂ ਕਈ ਵਾਰ ਮੈਂ ਕਿਸੇ ਕਿਤਾਬ ਦਾ ਪੰਨਾ ਪਰੜਦਾ ਐਂ ਪਹਿਲਾ ਪੰਨਾ ਮੈਨੂੰ ਉਦੋਂ ਸਮਝ ਆ ਜਾਂਦੀ ਹੈ ਕਿ ਇਹਦੇ ਵਿੱਚ ਮੈਂ ਵਹਿ ਰਿਹਾ ਹਾਂ ਜਾਂ ਫਿਰ ਉਹਨੂੰ ਕੇਵਲ ਪੜ੍ਹ ਰਿਹਾ ਹਾਂ ਅਤੇ ਅਗਰ ਉਹਦਾ ਵਿਸ਼ਾ ਕੋਈ ਬਹੁਤ ਜ਼ਿਆਦਾ ਵਧੀਆ ਇੰਟਰਸਟਿੰਗ ਹੈ ਮੈਂ ਉਹਦੇ ਵਿੱਚ ਉਹਦੇ ਪਰਵਾਹ ਵਿੱਚ ਨਾਲ ਨਾਲ ਵਹਿ ਰਿਹਾ ਹਾਂ ਤਾਂ ਮੈਨੂੰ ਪਤਾ ਹੈ ਕਿ ਤਿੰਨ ਜਾਂ ਚਾਰ ਦਿਨਾਂ ਦੇ ਅੰਦਰ ਅੰਦਰ ਮੈਥੋਂ ਕਿਤਾਬ ਸਮਾਪਤ ਹੋ ਜਾਂਦੀ ਹੈ ਔਰ ਸਿੱਧਾ ਪੜ੍ਹਨ ਦੀ ਬਜਾਏ ਕਿਉਂਕਿ ਮੇਰੇ ਕੋਲ ਹਾਲਾਂਕਿ ਰੀਡਿੰਗ ਟੇਬਲ ਹੈਗਾ ਸਟਡੀ ਟੇਬਲ ਹੈਗਾ ਅਤੇ ਲਗਭਗ ਢਾਈ ਤਿੰਨ ਘੰਟੇ ਮੈਂ ਸਿੱਧਾ ਬਹਿ ਕੇ ਪੜ੍ਹ ਲੈਂਦਾ ਫਿਰ ਵਿੱਚੋਂ ਚਾਹ ਵਾਹ ਪੀ ਲਈ ਜਾਂ ਕੋਈ ਗੱਲਬਾਤ ਕਰ ਲਈ ਹੈ ਨਾ ਅਤੇ ਮੈਂ ਇੱਦਾ ਕਰਕੇ ਆਪਦਾ ਟਾਸਕ ਪੂਰਾ ਕਰ ਲੈਂਦਾ ਹਾਂ ਧੰਨਵਾਦ ਜੀ